ਇੱਕੀ ਨਵੰਬਰ ਉੱਨੀ ਸੌ ਛਿਆਨਵੇਂ ਇੱਕੀ ਮਾਰਚ ਦੋ ਹਜ਼ਾਰ ਦਸ ਪੰਦਰ੍ਹਾਂ ਅਗਸਤ ਉੱਨੀ ਸੌ ਸਤਾਨਵੇਂ ਅਠਾਰ੍ਹਾਂ ਜਨਵਰੀ ਦੋ ਹਜ਼ਾਰ ਅੱਠ ਸੋਲ੍ਹਾਂ ਅਗਸਤ ਉੱਨੀ ਸੌ ਪਚਾਨਵੇਂ